ਬਦਲਦੇ ਮੌਸਮ ਦਾ ਸਾਡੇ ਖੇਤਰ ਵਿੱਚ ਬਹੁਤ ਬੁਰਾ ਅਸਰ ਪੈਂਦਾ ਹੈ ਜਿਵੇਂ ਕਿ ਹੜ੍ਹ ਸਾਡੀ ਫ਼ਸਲ ਨੂੰ ਬਹੁਤ ਖ਼ਰਾਬ ਕਰਦੇ ਹਨ ਜਿਵੇਂ ਪਾਣੀ ਪਾਣੀ ਦਾ ਨਿਕਾਸ ਉਸ ਕਿਸੇ ਪਾਸੇ ਨਹੀਂ ਜਾਂਦਾ ਪਾਣੀ ਕਾਰਨ ਸਾਡੀਆਂ ਫ਼ਸਲਾਂ ਦਾ ਝਾੜ ਘੱਟ ਹੋ ਜਾਂਦਾ ਹੈ ਜਿਵੇਂ ਸੋਕਾ ਸੋਕੇ ਦੀ ਗੱਲ ਕਰੀਏ ਕਿ ਜਿਵੇਂ ਪਾਣੀ ਨਹਿਰਾਂ ਵਿੱਚ ਵੀ ਘੱਟ ਹੁੰਦਾ ਹੈ ਫ਼ਸਲਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਦਿਨੋ ਦਿਨ ਪਾਣੀ ਦਾ ਨਿਕਾਸ ਘੱਟ ਰਿਹਾ ਹੈ ਇਸ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਆਉਂਦੀ ਹੈ ਇਸ ਰੁਕਾਵਟ ਨਾਲ ਨਜਿੱਠਣ ਵਾਸਤੇ ਕਿਸਾਨਾਂ ਨੂੰ ਧਰਨੇ ਲਗਾਉਣੇ ਪੈਂਦੇ ਹਨ ਕਿਸਾਨ ਵੱਲੋਂ ਸਰਕਾਰ ਵੱਲੋਂ ਕਿਸਾਨਾਂ ਨੂੰ ਜੋ ਬੀਮਾ ਕੀਤਾ ਜਾਂਦਾ ਹੈ ਉਸ ਦਾ ਕੁਛ ਫਾਇਦਾ ਹੁੰਦਾ ਹੈ